ਮੰਮੀ ਮੈਂ ਨਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾ ਪਹਿਲੀ ਵਾਰ ਨਾ ਕਰੇਲੇ ਬਣਾਏ ਅਤੇ ਉਹ ਉਹਦੇ ਵਿੱਚ ਪਹਿਲਾਂ ਮੈਂ ਉਹਨਾਂ ਨੂੰ ਛਿੱਲ ਕੇ ਫਿਰ ਉਹਨਾਂ ਨੂੰ ਜਰਾ ਕੁ ਧੁੱਪੇ ਰੱਖ ਦਿੱਤਾ ਸੁੱਕਣ ਵਾਸਤੇ ਜਦੋਂ ਉਹ ਸੁੱਕ ਗਏ ਅਤੇ ਫਿਰ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕੀਤਾ ਤੇਲ ਵਿੱਚ ਅਤੇ ਬਾਅਦ ਵਿੱਚ ਉਹਦੇ ਵਿੱਚ ਨਾ ਮਸਾਲਾ ਜਿਹੜਾ ਭਰਨ ਵਾਲਾ ਸੀ ਅਤੇ ਉਹ ਉਹ ਮੈਨੂੰ ਪਤਾ ਨਹੀਂ ਕਿੱਦਾਂ ਕਰਨਾ ਸੀ ਫਿਰ ਮੈਂ ਇੱਕ ਵਾਰ ਮਸਾਲਾ ਸਾਰਾ ਛਿੱਲ ਕੇ ਕੱਟ ਕੇ ਅਤੇ ਵਿੱਚ ਗਰਾਇੰਡ ਕਰਕੇ ਫਿਰ ਉਹਨੂੰ ਥੋੜ੍ਹਾ ਜਿਹਾ ਤੇਲ ਦੇ ਉੱਤੇ ਤੜਕ ਕੇ ਵਿੱਚ ਲੂਣ ਮਿਰਚ ਮਸਾਲਾ ਸਾਰਾ ਕੁਛ ਪਾ ਦਿੱਤਾ ਸੀਗਾ ਅਤੇ ਉਹਨੂੰ ਥੋੜ੍ਹਾ ਜਿਹਾ ਫਰਾਈ ਕਰਕੇ ਫਿਰ ਉਹਨੂੰ ਕੱਢ ਕੇ ਫਿਰ ਜਿਹੜੇ ਕਰੇਲੇ ਫਰਾਈ ਕੀਤੇ ਸੀ ਉਹਦੇ ਵਿੱਚ ਪਾ ਤਾ ਉਹਦੇ ਵਿੱਚ ਕਰੇਲਿਆਂ ਨੂੰ ਥੋੜ੍ਹਾ ਜਿਹਾ ਚੀਰਾ ਦੇ ਕੇ ਵਿੱਚ ਭਰ ਕੇ ਫਿਰ ਉਹਨਾਂ ਦੇ ਉੱਤੇ ਮੈਂ ਥੋੜ੍ਹਾ ਜਿਹਾ ਧਾਗਾ ਜਿਹੜਾ ਸੀ ਲਪੇਟਿਆ ਅਤੇ ਤਾਂ ਜੋ ਮਸਾਲਾ ਬਾਹਰ ਨਾ ਨਿਕਲੇ ਫਿਰ ਦੁਬਾਰਾ ਉਹਨਾਂ ਨੂੰ ਮਸਾਲਾ ਭਰ ਕੇ ਫਿਰ ਮੈਂ ਥੋੜ੍ਹਾ ਜਿਹਾ ਕੜਾਹੀ 'ਚ ਤੇਲ ਪਾ ਕੇ ਨਾ ਉਹਨੂੰ ਥੋੜ੍ਹਾ ਜਿਹਾ ਗਰਮ ਕਰਕੇ ਅਤੇ ਉਹਦੇ ਵਿੱਚ ਫਿਰ ਅੱਧਾ ਘੰਟਾ ਉਹਨਾਂ ਨੂੰ ਫਰਾਈ ਕੀਤਾ ਜਿਸ ਤੋਂ ਕਾਰਨ ਉਹ ਬਾਅਦ ਵਿੱਚ ਸਹਿਜੇ ਸਹਿਜੇ ਲਾਲ ਹੁੰਦੇ ਗਏ ਲਾਲ ਹੋ ਕੇ ਅਤੇ ਪੱਕ ਗਏ ਅਤੇ ਬਾਅਦ ਚੋਂ ਖਾ ਖਾਦੇ ਅਸੀਂ ਬੜੇ ਸਵਾਦ ਬਣੇ ਸੀ